ਇਹ ਮੈਨੂੰ ਫੋਟੋਗ੍ਰਾਫੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜਿਵੇਂ ਕਿ ਮੈਂ ਇਹ ਵਿਆਹ ਸ਼ਾਦੀਆਂ 'ਚ ਇਹ ਇੰਸਟਾਗ੍ਰਾਮ ਸੋਸ਼ਲ ਮੀਡੀਆ 'ਤੇ ਇਹ ਮਤਲਬ ਯੂਟਿਊਬ 'ਤੇ ਮਤਲਬ ਕਈ ਜਗ੍ਹਾ ਮੈਂ ਆਪਣਾ ਇਹ ਫੋਟੋਗ੍ਰਾਫੀ ਮਤਲਬ ਇਹ ਸੋਸ਼ਲਲਾਈਜ ਕਰਦਾ ਹੈ ਇਹ ਤਾਂ ਇਸ ਲਈ ਜਿੱਦਾਂ ਹੁਣ ਮੈਂ ਕੋਈ ਵਿਆਹ ਮਤਲਬ ਮੈਂ ਆਪਣਾ ਇਹ ਕੰਮ ਵੀ ਕਰਦਾ ਇਹ ਫੋਟੋਗ੍ਰਾਫੀ ਦਾ ਇਹ ਜਿਵੇਂ ਜਿੱਦਾਂ ਡਰੋਨ ਵਗੈਰਾ ਵਿ ਵਿਆਹਾਂ ਦਾ ਸ਼ੂਟ ਹੋ ਗਿਆ ਮੂਵੀ ਦਾ ਕੋਈ ਸ਼ੂਟ ਹੋ ਗਿਆ ਕੁਛ ਸ਼ੋਟ ਫਿਲਮ ਦਾ ਸ਼ੂਟ ਹੋ ਗਿਆ ਤਾਂ ਮੈਂ ਚਾਰਜਿਸ ਵੀ ਰੱਖੇ ਹੋਏ ਆ ਉਹਦੇ ਤਾਂ ਇਸ ਕਰਕੇ ਏ ਮੈਂ ਹਜੇ ਤੱਕ ਤਾਂ ਮੈਂ ਇਹ ਅੰਤਰਰਾਸ਼ਟਰੀ ਪੱਧਰ 'ਤੇ ਫੋਟੋਗ੍ਰਾਫੀ 'ਚ ਚਲੋ ਨਹੀਂ ਗਿਆ ਇਹ ਬਾਕੀ ਮੇਰਾ ਜੋ ਦਿਲ ਦਾ ਦਿਲ ਦੀ ਇੱਛਾ ਹੈ ਇਹ ਸੋਸ਼ਲ ਮੀਡੀਆ ਮਤਲਬ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਮੈਂ ਇਹ ਇਸ ਦੇ ਵਿੱਚ ਜਾਣਾ ਚਾਹੁੰਦਾ ਇੰਟਰਨੈਸ਼ਨਲ ਹਿੱਸਾ ਲਿਆ ਨਹੀਂ ਹਜੇ ਤੱਕ ਤਾਂ ਬਾਕੀ ਮੈਂ ਲੈਣਾ ਚਾਹੁੰਦਾ ਹੈ ਬਾਕੀ ਇਹ ਮੈਨੂੰ ਜਿਹੜੇ ਬਾਕੀ ਇਹਨਾਂ ਦੇ ਨਾਲ ਜਿਹੜੇ ਜਿਹੜੇ ਇਹ ਵੱਡੇ ਇੰਟਰਨੈਸ਼ਨਲ ਇਹ ਫੋਟੋਗ੍ਰਾਫਰ ਹੈ ਮੈਨੂੰ ਉਹਦੇ ਨਾਲ ਬੈਠਣ ਦਾ ਮੌਕਾ ਮਿਲਣਾ ਤੇ ਬਾਕੀ ਜਿਹੜੇ ਅਵਾਰਡ ਵਗੈਰਾ ਹੈ ਜਿਵੇਂ ਸੋਨੀ ਵਰਲਡ ਫਰੋਕ ਹੋਏ ਫੋਟੋਗ੍ਰਾਫੀ ਅਵਾਰਡ ਹੋ ਗਿਆ ਇਹ ਜਿਵੇਂ ਲੰਡਨ ਫੋਟੋ ਸ਼ੋ ਅਵੋਰਡ ਹੋ ਗਿਆ ਐਗਜ਼ੀਬਿਸ਼ਨ ਜਿਵੇਂ ਏ ਓ ਪੀ ਓਪਨ ਅਵਾਰਡ ਹੋ ਗਿਆ ਐਨ ਆਈ ਏ ਨੋਨਪ੍ਰੋਫਿਟ ਫੋਟੋ ਇਹ ਕੋਂਟੈਸਟ ਹੋ ਗਿਆ ਇੰਟਰਨੈਸ਼ਨਲ ਫੋਟੋ ਇਹ ਗਰਾਫੀ ਅਵਾਰਡ ਹੋ ਗਿਆ ਦ ਨੇਚਰ ਫੋਟੋਗ੍ਰਾਫੀ ਕੰਟੈਸਟ ਵਾਇਲਡ ਫੋਟੋ ਅਵਾਰਡ ਇਹ ਜਿੰਨੇ ਵੀ ਮਤਲਬ ਇਹਨਾਂ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਣਾ ਇਹ ਤਾਂ ਮੈਂ ਇਸ ਇਸ ਨਾਲ ਮੇਰੀ ਤਿਆਰੀ ਪੂਰੀ ਹੈ ਬਾਕੀ ਮੈਨੂੰ ਜਦੋਂ ਵੀ ਮੌਕਾ ਮਿਲਿਆ ਤਾਂ ਮੈਂ ਇਸ ਵਿੱਚ ਹਿੱਸਾ ਜ਼ਰੂਰ ਲਵਾਂਗਾ ਜੀ